ਪੱਚੀ ਜਨਵਰੀ ਦੋ ਹਜ਼ਾਰ ਚੌਵੀ ਸੋਲਾਂ ਮਾਰਚ ਦੋ ਹਜ਼ਾਰ ਤੇਈ ਸਤਾਰਾਂ ਫਰਵਰੀ ਦੋ ਹਜ਼ਾਰ ਬਾਈ ਛੱਬੀ ਜਨਵਰੀ ਦੋ ਹਜ਼ਾਰ ਇੱਕੀ ਅਤੇ ਤੇਈ ਮਾਰਚ ਦੋ ਹਜ਼ਾਰ ਚੌਵੀ